ਮੇਰੀ ਲਿਖਣ ਦੀ ਪ੍ਰਕਿਰਿਆ ਮਾਡਰਨ ਸ਼ੈਲੀ ਹੈ ਹਾਂਜੀ ਮੈਂ ਰੂਪ ਲਿਪ ਰੂਪ ਲੇਖਾ ਬਣਾਉਂਦੀ ਹਾਂ ਜੋ ਲਿਖਣ ਵਿੱਚ ਮੇਰੀ ਬਹੁਤ ਮਦਦ ਕਰਦੀ ਹੈ ਰੂਪ ਲੇਖਾ ਦੀ ਮਦਦ ਨਾਲ ਮੈਂ ਬਹੁਤ ਹੀ ਵਧੀਆ ਤਰੀਕੇ ਨਾਲ ਅਤੇ ਸੋਹਣਾ ਲਿਖ ਪਾਉਂਦੀ ਹਾਂ ਫਿਰ ਮੈਂ ਡਰਾਫਟ ਲਿਖਦੀ ਹਾਂ ਅਤੇ ਬਾਅਦ ਵਿੱਚ ਉਸਨੂੰ ਸੋਧਦੀ ਹਾਂ ਮੈਂ ਡਰਾਫਟ ਤਿੰਨ ਜਾਂ ਚਾਰ ਵਾਰੀ ਲਿਖਦੀ ਹਾਂ ਭਾਸ਼ਾ ਦੀ ਪ੍ਰਮਾਣਿਕਤਾ ਨੂੰ ਸਭ ਤੋਂ ਵੱਧ ਲੋਚਦੀ ਹਾਂ ਲਿਖਣ ਵੇਲੇ ਮੈਂ ਆਪਣੇ ਅਧਿਆਪਕ ਜਾਂ ਆਪਣੀ ਭਾਸ਼ਾ ਦੀ ਪੁਸਤਕ ਦੀ ਮਦਦ ਲੈਂਦੀ ਹਾਂ ਅਤੇ ਆਪਣੇ ਅਧਿਆਪਕ ਦੀ ਹੀ ਸਲਾਹ ਲੈਂਦੀ ਹਾਂ ਧੰਨਵਾਦ